ਕਲਾ ਲੋਕ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਮਤਲਬ ਕਿ ਵਧੀਆ ਕੱਪੜੇ ਪਾਉਂਦੇ ਹਨ ਜਿਵੇਂ ਕਿ ਸਾਡੇ ਪੰਜਾਬ ਵਿੱਚ ਇਹਨਾਂ ਕੱਪੜਿਆਂ ਦਾ ਕੁੜੀਆਂ ਘੱਗਰੇ ਪਾਉਂਦੀਆਂ ਹਨ ਲਹਿੰਗੇ ਪਾਉਂਦੀਆਂ ਹਨ ਅਤੇ ਸਲਵਾਰ ਸੂਟ ਸਲਵਾਰ ਸੂਟ ਪਾਉਂਦੀਆਂ ਹਨ ਜਿਨ੍ਹਾਂ ਦਾ ਸਾਡੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਜ਼ਿਆਦੀ ਮਹਾਨਤਾ ਹੈ ਕੁੜੀਆਂ ਸਲਵਾਰ ਸੂਟ ਪਾਉਂਦੀਆਂ ਹਨ ਅਤੇ ਫੁਲਕਾਰੀ ਲੈਂਦੀਆਂ ਹਨ ਮੁੰਡੇ ਗਲਾਂ ਵਿੱਚ ਕੈਂਠੇ ਪਾਉਂਦੇ ਹਨ ਚਾਦਰੇ ਲਾਉਂਦੇ ਹਨ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਸੱਭਿਆਚਾਰਕ ਲਈ ਖਾਸ ਹੁੰਦੇ ਹਨ ਲੋਕ ਬਹੁਤ ਮੁੰਡੇ ਚਾਦਰੇ ਲਾ ਕੇ ਬਹੁਤ ਮੁੰਡੇ ਚਾਦਰੇ ਲਾਉਂਦੇ ਹਨ ਜਿਸ ਨਾਲ ਉਹਨਾਂ ਨੂੰ ਜਿਸ ਨਾਲ ਲੋਕ ਜਿਸ ਨਾਲ ਪੰਜਾਬ ਵਿੱਚ ਸੱਭਿਅਤਾ ਵੱਧ ਜਾਂਦੀ ਹੈ ਕੁੜੀਆਂ ਲਹਿੰਗੇ ਪਾਉਂਦੀਆਂ ਹਨ ਜਾਂ ਅਤੇ ਟਿੱਕਾ ਸੈੱਟ ਟਿੱਕਾ ਟਿੱਕਾ ਸੈੱਟ ਅਤੇ ਵਧੀਆ ਮੁਟਿਆਰਾਂ ਪੰਜਾਬਣ ਮੁਟਿਆਰਾਂ ਬਣਦੀਆਂ ਹਨ ਅੱਜ ਇਸ ਨਾਲ ਸਾਡੇ ਸੱਭਿਆਚਾਰ ਦੀ ਟੋ ਇਸ ਨਾਲ ਸਾਡੇ ਸੱਭਿਆਚਾਰ ਦੀ ਟੋਰ ਬਣਦੀ ਹੈ ਅਤੇ ਸੱਭਿਆਚਾਰ ਵਧੀਆ ਬਣਦਾ ਹੈ ਜਿਸ ਨਾਲ ਜਿਸ ਨਾਲ ਉਹ ਪੰਜਾਬੀ ਉਹ ਪੰਜਾਬੀ ਪਹਿਰਾਵੇ ਨੂੰ ਪਾਉਂਦੇ ਹਨ ਅਤੇ ਉਹਨਾਂ ਦਾ ਪੰਜਾਬੀ ਪਹਿਰਾਇਆ ਪਹਿਰਾਵਾ ਉਨ੍ਹਾਂ ਦੇ ਪਾਇਆ ਹੋਇਆ ਦਿਸਦਾ ਹੈ